ਜੀ ਹਾਂ ਭੰਗੜਾ ਐਰੋਬਿਕਸ ਸਰੀਰਿਕ ਗਤੀਵਿਧੀਆਂ ਦੇ ਤੌਰ 'ਤੇ ਵਧੀਆ ਕਸਰਤ ਹੈ ਭੰਗੜਾ ਇੱਕ ਅਜਿਹਾ ਨਾਚ ਹੈ ਜੋ ਆਪਣੀਆਂ ਬਹੁਤ ਹੀ ਊਰਜਾਵਾਨ ਅਤੇ ਉਤਸ਼ਾਹੀ ਚਾਲਾਂ ਲਈ ਪ੍ਰਸਿੱਧ ਹੈ ਡਾਂਸ ਕਸਰਤ ਵਿੱਚ ਨਿਰੰਤਰ ਅਤੇ ਤਾਲਬੱਧ ਹਰਕਤਾਂ ਸ਼ਾਮਿਲ ਹੁੰਦੀਆਂ ਹਨ ਇਸ ਤਰ੍ਹਾਂ ਇਹ ਤੁਹਾਡੇ ਸਰੀਰ ਲਈ ਇੱਕ ਵਧੀਆ ਐਰੋਬਿਕ ਕਸਰਤ ਬਣਾਉਂਦੀ ਹੈ ਇਹ ਤੁਹਾਡੀਆਂ ਬਾਹਾਂ ਕੋਲੇ ਅਤੇ ਲੱਤਾਂ ਦੀਆਂ ਮਾਂਸਪੇਸ਼ੀਆਂ ਨੂੰ ਟੋਨ ਕਰਨ ਵਿੱਚ ਵੀ ਮਦਦ ਕਰਦਾ ਹੈ ਕੁਸ਼ਲ ਕੈਲੋਰੀ ਬਰਨ ਇਹਨਾਂ ਭੰਗੜਿਆਂ ਦੀਆਂ ਹਰਕਤਾਂ ਦਾ ਪੰਤਾਲੀ ਮਿੰਟ ਦਾ ਸੈਸ਼ਨ ਪੰਜ ਸੋ ਕੈਲੋਰੀਆਂ ਤੱਕ ਬਰਨ ਕਰ ਸਕਦਾ ਹੈ ਇਹ ਤੁਹਾਡੇ ਭਾਰ ਘਟਾਉਣ ਦੇ ਰੂਟੀਨ ਨੂੰ ਮਜ਼ੇਦਾਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਦਿਲ ਦੇ ਕੰਮ ਨੂੰ ਵਧਾਉਂਦਾ ਹੈ ਭੰਗੜਾ ਕਸਰਤ ਇੱਕ ਮਜ਼ੇਦਾਰ ਗਤੀਵਿਧੀ ਹੋ ਸਕਦੀ ਹੈ ਪਰ ਇਹ ਦਿਲ ਨੂੰ ਸਿਹਤਮੰਦ ਰੱਖਣ ਵਾਲੀ ਕਸਰਤ ਵੀ ਹੈ ਇਹ ਦਿਲ ਦੀ ਬਿਮਾਰੀ ਹਾਈਪਰ ਹਾਈਪਰਟਾਈਸ਼ਨ ਅਤੇ ਸਕੋਟ ਵਰਗੀਆਂ ਪੁਰਾਣੀਆਂ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਕਰ ਸਕਦੀ ਹੈ ਅਤੇ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਵੀ ਘਟਾ ਸਕਦੀ ਹੈ ਇਸ ਕਸਰਤ ਲਈ ਤੁਹਾਨੂੰ ਸਿਰਫ ਜੁੱਤੀਆਂ ਦੀ ਇੱਕ ਜੋੜੀ ਅਤੇ ਤੁਹਾਡੇ ਮਨਪਸੰਦ ਗੀਤਾਂ ਦੀ ਇੱਕ ਪਲੇਲਿਸਟ ਦੀ ਲੋੜ ਹੈ ਧੰਨਵਾਦ